ਰਾਜ ਦੇ ਆਲੇ ਦੁਆਲੇ ਜਾਣ ਦੇ ਕਾਫੀ ਤਰੀਕੇ ਹਨ ਅਤੇ ਇੱਥੇ ਯਾਤਰਾਵਾਂ ਲਈ ਆਵਾਜਾਈ ਦੇ ਕਾਫੀ ਵਧੀਆ ਢੰਗ ਹਨ ਜਿਵੇਂ ਕਿ ਬੱਸਾਂ ਚੱਲਦੀਆਂ ਨੇ ਔਟੋ ਚੱਲਦੇ ਨੇ ਜੇਕਰ ਕੋਈ ਯਾਤਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਚਾਹੁੰਦਾ ਏ ਅਤੇ ਉਹ ਆਪਣਾ ਔਟੋ ਵੀ ਪ੍ਰੈਫਰ ਕਰ ਸਕਦਾ ਬੱਸਿਜ਼ ਵੀ ਕਰ ਸਕਦਾ ਠੀਕ ਆ ਨਾ ਪਰ ਉਹ ਡਿਪੈਂਡ ਕਰਦਾ ਕਿ ਯਾਤਰਾ ਅਤੇ ਯਾਤਰਾਵਾਂ ਦੀ ਸੰਖਿਆ ਕਿੰਨੀ ਹੈ ਜੇਕਰ ਯਾਤਰਾਵਾਂ ਦੀ ਸੰਖਿਆ ਜ਼ਿਆਦਾ ਆ ਅਤੇ ਉਹ ਕੀ ਕਰ ਸਕਦੇ ਵੱਡੀ ਬੱਸ ਬੁੱਕ ਕਰ ਸਕਦੇ ਆ ਜੋ ਕਿ ਉਹਨਾਂ ਨੂੰ ਪੂਰਾ ਘੁੰਮਾਏਗੀ ਉਹਦੇ 'ਚ ਉਹਨਾਂ ਨੂੰ ਪੂਰਾ ਪੈਕੇਜ਼ ਇੰਕਲੂਡ ਹੁੰਦਾ ਉਹ ਫਿਰ ਬੱਸ ਵਾਲਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਘੁੰਮਾਉਂਦਾ ਉਹਦੇ 'ਚ ਗਾਈਡਰ ਵੀ ਉਨ੍ਹਾਂ ਦਾ ਇੰਕਲੂਡ ਹੁੰਦਾ ਹੁਣ ਤਾਂ ਪੰਜਾਬ ਵਿੱਚ ਇੱਕ ਵਧੀਆ ਫੈਸਿਲਿਟੀ ਆ ਗਈ ਹੈ ਕਿ ਬੰਦੇ ਬਾਰਤ ਟਰੇਨ ਚੱਲ ਪਈ ਆ ਜੋ ਕਿ ਯਾਤਰਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੰਜਾਬ ਦੇ ਵਿੱਚ ਹੀ ਵੱਖਰੀ ਵੱਖਰੀ ਜਗ੍ਹਾਵਾਂ 'ਤੇ ਲਿਖਾ ਲਿਜਾ ਲਿਜਾ ਸਕਦਾ ਉੱਥੇ ਉਹਨਾਂ ਨੂੰ ਰਹਿਣ ਦੀ ਵਿਵਸਥਾ ਮਿਲ ਜੇਗੀ ਖਾਣ ਦੀ ਮਿਲ ਜੇਗੀ ਉਹ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਵਿਵਸਥਾਵਾਂ ਉਹਨਾਂ ਨੂੰ ਆਰਾਮ ਨਾਲ ਮਿਲ ਜਾਣਗੀਆਂ ਅਤੇ ਇਸ ਤਰ੍ਹਾਂ ਹੀ ਆਪਣਾ ਕੈਬ ਵੀ ਉਹ ਕਰ ਸਕਦੇ ਨੇ ਜੇਕਰ ਸੰਖਿਆ ਉਹਨਾਂ ਦੀ ਘੱਟ ਆ ਅਤੇ ਉਹ ਕੈਬ ਦੇ ਰਾਹੀਂ ਵੀ ਜਾ ਸਕਦੇ ਨੇ ਠੀਕ ਆ ਜੇਕਰ ਸ਼ੌਰਟ ਡਿਸਟੈਂਸ 'ਤੇ ਜਾਣਾ ਫਿਰ ਆਪਣਾ ਔਟੋ ਵਗੈਰਾ ਬੁੱਕ ਕਰਕੇ ਜਾ ਸਕਦੇ ਨੇ